ਸਪੀਕ ਆਊਟ ਦਾ ਫੋਲੋਇੰਗ ਨੇਮਸ ਔਫ ਲੋਕੇਸ਼ਨਸ ਸੈਂਟ ਲੂਸੀਆ ਵਰਕ ਫਿਲਪੀਨਸ ਸਵਿਜ਼ਰਲੈਂਡ ਅਮੇਰੀਕਾ ਯੂਨਾਈਟਡ ਕਿੰਗਡਮ ਯੋਰਪ ਫਰਾਂਸ ਇੰਡੀਆ ਪਾਕਿਸਤਾਨ ਚਾਈਨਾ ਨੇਪਾਲ ਭੂਟਾਨ ਫਰਾਂਸ ਪੈਰਿਸ ਇਟਲੀ ਐਂਡ ਜਰਮਨੀ